ਛੱਬੀ ਜੁਲਾਈ ਦੋ ਹਜ਼ਾਰ ਦੋ ਪੱਚੀ ਜੁਲਾਈ ਦੋ ਉੱਨੀ ਸੌ ਪੰਝੱਤਰ ਪੰਜ ਜੁਲਾਈ ਉੱਨੀ ਸੌ ਬਹੱਤਰ ਇੱਕ ਜਨਵਰੀ ਦੋ ਹਜ਼ਾਰ ਵੀਹ ਬਾਰਾਂ ਅਗਸਤ ਉੱਨੀ ਸੌ ਨੜ੍ਹਿਨਵੇਂ